ਮੈਂ ਹਰ ਇੱਕ ਮੂਮੈਂਟ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰਦੀ ਹਾਂ ਇਸ ਕਰਕੇ ਮੈਂ ਆਪਣਾ ਇੱਕ ਛੋਟਾ ਜਿਹਾ ਕੈਮਰਾ ਪਰਚੇਜ਼ ਕੀਤਾ ਹੋਇਆ ਹੈ ਜਿਹਨੂੰ ਮੈਂ ਹਮੇਸ਼ਾਂ ਹੀ ਆਪਣੇ ਕੋਲ ਰੱਖਦੀ ਹਾਂ ਅਤੇ ਹਰ ਇੱਕ ਮੂਮੈਂਟ ਨੂੰ ਉਹਦੇ ਵਿੱਚ ਕੈਪਚਰ ਕਰਨ ਦੀ ਕੋਸ਼ਿਸ਼ ਕਰਦੀ ਹਾਂ ਉਹ ਮੈਂ ਕਿਉਂ ਮੈਂ ਇਸ ਲਈ ਕਰਦੀ ਹਾਂ ਤਾਂ ਜੋ ਜਦੋਂ ਮੈਂ ਉਸ ਚੀਜ਼ ਨੂੰ ਕੁਝ ਸਾਲਾਂ ਬਾਅਦ ਦੇਖਾਂ ਤਾਂ ਓਸ ਚੀਜ਼ਾਂ ਨੂੰ ਮੈਂ ਫਿਰ ਤੋਂ ਇੰਜੋਏ ਕਰ ਸਕਾਂ ਜਿਵੇਂ ਮੇਰੇ ਫਰੈਂਡਸ ਦੇ ਨਾਲ਼ ਕੁਝ ਫੋਟੋਜ਼ ਮੈਂ ਖਿੱਚੀਆਂ ਸੀਗੀਆਂ ਜਿਹੜੀਆਂ ਕਿ ਮੈਨੂੰ ਹੁਣ ਯਾਦ ਆਉਂਦੀਆਂ ਨੇ ਕਿ ਅਸੀਂ ਕਿੰਨਾਂ ਇੰਜੋਏ ਕਰਦੇ ਸੀਗੇ ਮੇਰੇ ਕਿਹੜੇ ਕਿਹੜੇ ਫਰੈਂਡਸ ਕਿੱਦਾਂ ਕਿੱਦਾਂ ਦੇ ਹੁੰਦੇ ਸੀਗੇ ਉਹਨਾਂ ਦੀਆਂ ਜੋ ਵੀ ਫੋਟੋਜ਼ ਹੁੰਦੀਆਂ ਸੀਗੀਆਂ ਬਹੁਤ ਹਾਸੀ ਮਜ਼ਾਕ ਵਾਲੀਆਂ ਫੋਟੋਜ਼ ਵੀਡੀਓਜ਼ ਉਹ ਅਸੀਂ ਬਣਾਉਂਦੇ ਸੀਗੇ ਕੋਲੇਜ ਟਾਈਮ ਦੇ ਵਿੱਚ ਜਦੋਂ ਹੁਣ ਮੈਂ ਮਤਲਬ ਇੰਨੇ ਮੇਰੀ ਸਟੱਡੀ ਨੂੰ ਤਿੰਨ ਚਾਰ ਸਾਲ ਹੋ ਗਏ ਹੁਣ ਮੈਂ ਜਦੋਂ ਉਹਨਾਂ ਫੋਟੋਜ਼ ਨੂੰ ਦੇਖਦੀ ਹਾਂ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਏ ਆ